ਪੰਜਾਬੀ ਪਰਿਵਾਰ ਆਪਸ ਵਿੱਚ ਮਿਲ ਕੇ ਰਹਿੰਦੇ ਹਨ ਪੁਰਾਣੀਆਂ ਯਾਦਾਂ ਪੁਰਾਣੇ ਕਿੱਸੇ ਕਹਾਣੀਆਂ ਆਪਣੇ ਇੱਕ ਦੂਜੇ ਨਾਲ ਮੇਲ ਮਿਲਾਪ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਾਂ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਇੱਕ ਦੂਜੇ ਦਾ ਮੋਹ ਪਿਆਰ ਕਰਨਾ ਜਦੋਂ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਅੱਜ ਦੀ ਪੀੜ੍ਹੀ ਵਿੱਚ ਗਿਆਨ ਵੰਡਦੀਆਂ ਕਿਉਂਕਿ ਜਦੋਂ ਕੁਝ ਨੌਜਵਾਨ ਅੱਜ ਦੀ ਪੀੜ੍ਹੀ ਦਾ ਨੌਜਵਾਨ ਪੁਰਾਣਿਆਂ ਬਜ਼ੁਰਗਾਂ ਦੇ ਨਾਲ ਮਿਲਦਾ ਹੈ ਅਤੇ ਉਹਨਾਂ ਦੇ ਵਿੱਚ ਜਦੋਂ ਆਪਸੀ ਪਿਆਰ ਪ੍ਰੇਮ ਭਾਵਨਾ ਦੀ ਹੁੰਦੀ ਹੈ ਉਹ ਚੀਜ਼ਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੁਰਾਣੀਆਂ ਪਰੰਪਰਾਵਾਂ ਯਾਦ ਕਰਾਉਣ ਵਿੱਚ ਸਹਾਇਤਾ ਕਰਦੀਆਂ